ਜੀ ਨਹੀਂ ਹਾਈਕਿੰਗ ਕਰਨ ਲਈ ਕੋਈ ਮੁਢਲੀ ਸਿੱਖਿਆ ਨਹੀਂ ਚਾਹੀਦੀ ਪਰ ਜਿੱਦਾਂ ਜਿੱਦਾਂ ਤੁਸੀਂ ਹਾਈਕਿੰਗ ਦੇ ਰੁਝਾਣ ਵੱਧਦਾ ਹੈ ਉਦਾਂ ਉਦਾਂ ਤੁਹਾਡਾ ਇਸ ਵਿੱਚ ਰੁਚੀ ਵੀ ਰੁਚੀ ਵੱਧਣ ਕਾਰਨ ਤੁਹਾਨੂੰ ਐਕਸਪੀਰੀਅੰਸ ਆਉਂਦਾ ਹੈ ਉਹ ਐਕਸਪੀਰੀਅੰਸ ਤੁਹਾਡੇ ਲਈ ਅੱਗੇ ਅੱਗੇ ਜਾ ਕੇ ਔਖੀ ਤੋਂ ਔਖੀ ਟਰੈਕਿੰਗ ਵੀ ਸੌਖੀ ਬਣਾਉਂਦਾ ਹੈ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਮੈਂ ਆਪਣੇ ਕਾਲਜ ਦੇ ਦੋਸਤਾਂ ਦੇ ਨਾਲ ਗਿਆ ਸੀ ਉਸ ਤੋਂ ਬਾਅਦ ਮੈਂ ਕਈ ਹੋਰ ਟਰੈਕਿੰਗ ਜਿਵੇਂ ਕਿ ਖੀਰ ਗੰਗਾ ਅਤੇ ਕਰੇਰੀ ਅਤੇ ਚਾਦਰ ਟਰੈਕ ਕਰਕੇ ਕਾਫ਼ੀ ਵਾਰ ਗਿਆ ਹਾਂ ਜੋ ਕਿ ਮੈਨੂੰ ਹੌਲੀ ਹੌਲੀ ਤਜ਼ਰਬੇ ਦੇ ਨਾਲ ਚਾਦਰ ਟਰੈਕ ਕਰਨ ਦੇ ਉੱਤੇ ਆਪਣਾ ਵਿਸ਼ਵਾਸ ਜਾਗਿਆ ਇਹ ਜ਼ਿਆਦਾਤਰ ਤਜਰਬੇ ਦਾ ਹੀ ਖੇਡ ਹੈ ਇਸ ਵਿੱਚ ਕੋਈ ਸਿੱਖਿਆ ਇੰਨੀ ਕਾਮਯਾਬ ਨਹੀਂ ਹੁੰਦੀ